ਮੈਂ ਇਕ ਬੁਟੀਕ ਜੋ ਮੇਰੀ ਖੁਦ ਦੀ ਹੈ ਉਸਦਾ ਕੰਮ ਕਰਦੀ ਹਾਂ ਮੈਂ ਇੱਕ ਸੂਟ ਦੀ ਕੀਮਤ ਉਸ ਦੀ ਟੈਕਸਚਰ ਸਿਲਾਈ ਮੈਥਡ 'ਤੇ ਨਿਰਭਰ ਕਰਦੀ ਹਾਂ ਭਾਵ ਸੂਟ ਸਿਊਣ ਵਿੱਚ ਬਹੁਤ ਸਾਰੀਆਂ ਵਰਾਇਟੀਆਂ ਆਉਂਦੀਆਂ ਹਨ ਜਿਸ ਵਿੱਚ ਸਿੰਪਲ ਸੂਟ ਪਟਿਆਲਾ ਸੂਟ ਸ਼ਰਾਰਾ ਗਰਾਰਾ ਲਾਈਨਿੰਗ ਵਾਲਾ ਪੈਂਟ ਪਲਾਜ਼ੋ ਘੇਰੇਦਾਰ ਪਲਾਜ਼ੋ ਸਕਰਟ ਆਦਿ ਕਈ ਤਰ੍ਹਾਂ ਦੀਆਂ ਕਿਸਮਾਂ ਦੇ ਸੂਟ ਤਿਆਰ ਕਰਦੀ ਹਾਂ ਇਸ ਲਈ ਉਸ ਸੂਟ ਦੀ ਸਿਊਣ ਦੀ ਤਕਨੀਕ ਜਾਂ ਸਟਾਈਲ 'ਤੇ ਹੀ ਸੂਟ ਦੀ ਸਿਲਾਈ ਦੀ ਕੀਮਤ ਤੈਅ ਹੁੰਦੀ ਹੈ ਵੈਸੇ ਮੈਂ ਇਕ ਸਿੰਪਲ ਸੂਟ ਦੀ ਸਿਲਾਈ ਢਾਈ ਸੌ ਰੁਪਏ ਲੈਂਦੀ ਹਾਂ ਬਾਕੀ ਜਿੰਨੀ ਵੀ ਖੇਤਰ ਨੇ ਉਹਨਾਂ ਵਿੱਚ ਸਿਲਾਈ ਦੇ ਆਪੋ ਆਪਣੇ ਵੱਖਰੇ ਰੇਟ ਹੋ ਸਕਦੇ ਹਨ ਕਿਤੇ ਖੇਤਰ ਵਿੱਚ ਇਹ ਰੇਟ ਘੱਟ ਜਾਂ ਜ਼ਿਆਦਾ ਹੋ ਸਕਦੇ ਹਨ